ਮਾਨਵਤਾ ਦਾ ਧਰਮ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਮੈਂ ਇਸੇ ਧਰਮ ਦਾ ਪਾਲਣਾ ਕਰਦਾ ਹਾਂ ਇਹ ਧਰਮ ਦੁਨੀਆ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਬਹੁਤ ਹੀ ਜ਼ਰੂਰੀ ਅਤੇ ਲਾਭਦਾਇਕ ਹੈ ਇਹੀ ਸਭ ਤੋਂ ਵੱਡਾ ਧਰਮ ਹੈ ਇਨਸਾਨ ਦਾ ਧਰਮ ਮਾਨਵਤਾ ਦਾ ਧਰਮ ਹੀ ਸਭ ਤੋਂ ਵੱਡਾ ਧਰਮ ਹੈ ਦੂਸਰੇ ਧਰਮਾਂ ਤੋਂ ਪਹਿਲਾਂ ਇਹੀ ਧਰਮ ਸਭ ਤੋਂ ਪਹਿਲਾਂ ਹੋਂਦ ਵਿੱਚ ਆਇਆ ਹੈ ਇਸ ਦੇ ਨਾਲ ਨਾਲ ਜੋ ਕਿ ਮਾਨਵਤਾ ਦੇ ਧਰਮ ਦੀ ਇੱਕ ਗੱਲ ਮੈਨੂੰ ਯਾਦ ਆਈ ਹੈ ਉਹ ਇਹ ਕਿ ਮਾਨਵਤਾ ਦੇ ਧਰਮ ਦੀ ਖਾਤਰ ਕਈ ਯੋਧਿਆਂ ਨੇ ਕਈ ਪੀਰਾਂ ਫਕੀਰਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਆਪਣੇ ਆਪ ਆਪਣੇ ਪਰਿਵਾਰਾਂ ਨੂੰ ਕੁਰਬਾਨ ਕੀਤਾ ਹੈ ਇਸੇ ਲੜੀ ਦੇ ਤਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਆਪਣੇ ਪਿਤਾ ਨੂੰ ਆਪਣੀ ਮਾਤਾ ਨੂੰ ਇਸ ਦੇਸ਼ ਦੇ ਧਰਮ ਨੂੰ ਮਾਨਵਤਾ ਨੂੰ ਬਚਾਉਣ ਦੀ ਖਾਤਰ ਜ਼ੁਲਮ ਦੇ ਸਾਹਮਣੇ ਦੀ ਖਾਤਰ ਇਸ ਦੇਸ਼ ਦੇ ਉੱਤੋਂ ਕੁਰਬਾਨ ਕੀਤਾ ਹੈ ਅਤੇ ਇਹ ਦੇਸ਼ ਦੀ ਮਾਨਵਤਾ ਧਰਮ ਨੂੰ ਬਚਾਇਆ ਹੈ ਇਹੀ ਧਰਮ ਦੀਆਂ ਸਿੱਖਿਆਵਾਂ ਸਾਨੂੰ ਅੱਗੇ ਵਧਣ ਅਤੇ ਸਭ ਨਾਲ ਪਿਆਰ ਸਾਂਝੀਵਾਲਤਾ ਦਾ ਪ੍ਰਤੀਕ ਸੰਦੇਸ਼ ਦੇਣ ਲਈ ਪ੍ਰੇਰਿਤ ਕਰਦੀਆਂ ਹਨ ਮਾਨਵਤਾ ਦਾ ਧਰਮ ਹੀ ਦੁਨੀਆ ਨੂੰ ਇੱਕੋ ਇੱਕ ਧਰਮ ਹੈ ਜੋ ਸਾਰੀ ਦੁਨੀਆ ਨੂੰ ਆਪਸ ਦੇ ਵਿੱਚ ਜੋੜ ਕੇ ਅਤੇ ਪਿਆਰ ਭਾਵ ਅਤੇ ਸਦਭਾਵਨਾ ਨਾਲ ਰੱਖ ਰਹਿਣ ਲਈ ਸਮਝਾ ਅਤੇ ਮਾਰਗਦਰਸ਼ਨ ਕਰ ਸਕਦਾ ਹੈ